ਅਸੀਂ ਆਪਣੇ ਚੱਲ ਰਹੇ ਰੁਟੀਨ ਵਿੱਚ ਤਾਕਤ ਅਤੇ ਲਚਕਦਾਰ ਸਿਖਲਾਈ ਨੂੰ ਇਸ ਤਰ੍ਹਾਂ ਲਿਆ ਸਕਦੇ ਹਾਂ ਕਿ ਰਨਿੰਗ ਕਰਕੇ ਭੱਜ ਕੇ ਅਤੇ ਵਧੀਆ ਖਾਣਾ ਖਾ ਕੇ ਤਾਜ਼ਾ ਫਰੈਸ਼ ਖਾਣਾ ਖਾ ਕੇ ਅਤੇ ਹੋਰ ਵਧੀਆ ਫ਼ਲ ਫਰੂਟ ਖਾ ਕੇ ਆਪਾਂ ਇੰਨਾ ਵਧੀਆ ਸਰੀਰ ਨੂੰ ਫਿੱਟ ਕਰ ਸਕਦੇ ਹਾਂ ਕਿ ਜੋ ਖਿੱਚ ਦਾ ਕੇਂਦਰ ਹੋਵੇ ਅਗਲਾ ਦੇਖ ਕੇ ਸਰੀਰ ਨੂੰ ਕਹੋ ਕਹੇ ਵਾਓ ਅਸੀਂ ਬਹੁਤ ਹੀ ਯੋਗਾ ਕਰਦੇ ਹਾਂ ਜੀ ਅਸੀਂ ਯੋਗਾ ਕਰਦੇ ਹਾਂ ਅਤੇ ਨਾਲ਼ੇ ਭੱਜਦੇ ਹਾਂ ਜੀ ਸੈਰ ਕਰਦੇ ਹਾਂ ਸਰੀਰ ਐਨ ਫਿੱਟ ਰਹਿੰਦਾ ਹੈ ਸਾਡਾ ਹਾਂਜੀ ਅਤੇ ਸਾਰੇ ਆਸ ਪੜੋਸ ਦੇ ਵੀ ਕਹਿੰਦੇ ਹਨ ਕਿ ਸਰੀਰ ਵਧੀਆ ਅਤੇ ਫਿੱਟ ਹੈ ਸਾਨੂੰ ਆਪਾਂ ਆਸ ਪੜੋਸ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਤੁਸੀਂ ਯੋਗਾ ਕਰੋ ਰਨਿੰਗ ਕਰੋ ਅਤੇ ਆਪਣਾ ਖਾਣਾ ਸਾਫ਼ ਸੁਥਰਾ ਖਾਉ ਅਤੇ ਸਰੀਰ ਨੂੰ ਫਿੱਟ ਬਣਾਓ ਹਾਂਜੀ